ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ਼ ਰਿਲੇਟਡ ਅਜਾਇਬ ਘਰ ਜਿਲ੍ਹਾ ਮੋਹਾਲੀ ਵਿੱਚ ਸਥਿਤ ਹੈ ਜਿੱਥੇ ਜਾ ਕੇ ਲੋਕਾਂ ਨੂੰ ਆਪਣੇ ਪੁਰਾਣੇ ਇਤਿਹਾਸ ਬਾਰੇ ਪਤਾ ਚੱਲਦਾ ਕਿ ਸਾਡੇ ਇਤਿਹਾਸ ਵਿੱਚ ਜਿਹੜੀਆਂ ਜੰਗਾਂ ਹੋਈਆਂ ਉਸਨੂੰ ਰੀਪ੍ਰਜੈਂਟ ਕਰਦਾ ਇਹ ਅਜਾਇਬ ਘਰ ਸਿੱਖ ਕੌਮ ਦੇ ਜਿਹੜੇ ਯੋਧੇ ਸੀਗੇ ਉਹਨਾਂ ਦੇ ਸਟੈਚੂ ਉੱਥੇ ਲੱਗੇ ਹੋਏ ਨੇ ਉੱਥੇ ਜਾ ਕੇ ਖੁਦ ਮੋਟੀਵੇਸ਼ਨਲ ਵਾਈਬਸ ਆਉਂਦੀਆਂ ਉਹ ਅਜਾਇਬ ਘਰ ਲੋਕਾਂ ਲਈ ਹੀ ਬਣਾਇਆ ਗਿਆ ਹੈ ਤਾਂ ਕਿ ਲੋਕ ਆਪਣੇ ਸਿੱਖ ਕੌਮ ਦੇ ਜਿਹੜੇ ਯੋਧੇ ਆ ਉਹਨਾਂ ਨੂੰ ਭੁੱਲ ਨਾ ਸਕੇ ਅਜਾਇਬ ਘਰ ਜਾਣ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਕਈ ਥਾਵਾਂ 'ਤੇ ਹੈ ਕਿ ਕੋਈ ਟਿਕਟ ਵਗੈਰਾ ਦਾ ਹੁੰਦਾ ਪਰ ਐਦਾਂ ਦਾ ਕੁਛ ਨਹੀਂ ਹੈ ਕਿ ਲੋਕ ਉੱਥੇ ਜਾ ਸਕਦੇ ਹੈ ਉਹਨਾਂ ਦੀ ਪਹੁੰਚ ਵਿੱਚ ਹੈ ਕੋਈ ਇਹ ਨਹੀਂ ਹੈ ਕਿ ਹਿਲ ਸਟੇਸ਼ਨ 'ਤੇ ਨਹੀਂ ਹੈ ਪਲੇਨ ਏਰੀਆ ਲੋਕ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ਼ ਜਾਗਰੂਕ ਕਰਾਉਣ ਦੇ ਲਈ ਆਪਣਾ ਖਾਲੀ ਸਮਾਂ ਬਿਤਾਉਣ ਦੇ ਲਈ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਐਂ